ਹੈਲੋ ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਮੈਂ ਤੁਹਾਡੀ ਕੈਬ ਸਰਵਿਸ ਤੋਂ ਕੈਬ ਬੁੱਕ ਕੀਤੀ ਸੀ ਜੋ ਕਿ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਲਈ ਸੀ ਅਤੇ ਮੈਂ ਤੁਹਾਨੂੰ ਬੇਅੰਤ ਕੋਲੇਜ ਦੇ ਬਾਹਰ ਮਿਲਣਾ ਸੀ ਪਰ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਆਪਣੇ ਘਰ ਤੋਂ ਬੇਅੰਤ ਕੋਲੇਜ ਵੱਲ ਨਿਕਲਿਆ ਤਾਂ ਅੱਜ ਮੈਨੂੰ ਰਸਤੇ ਵਿੱਚ ਬਹੁਤ ਜ਼ਿਆਦਾ ਟਰੈਫਿਕ ਮਿਲਿਆ ਜਿਸ ਕਾਰਨ ਮੈਂ ਟਰੈਫਿਕ ਵਿੱਚ ਫਸ ਗਿਆ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਲੇਟ ਹੋ ਜਾਵਾਂਗਾ ਜਿਸ ਨਾਲ ਬਹੁਤ ਜ਼ਿਆਦਾ ਸਮਾਂ ਬਰਬਾਦ ਹੋਵੇਗਾ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਕੋਈ ਹੋਰ ਤੇਜ਼ ਰਸਤਾ ਉਪਲਬਧ ਹੈ ਤਾਂ ਮੈਨੂੰ ਦੱਸਿਆ ਜਾਵੇ ਕਿ ਮੈਂ ਕਿੱਥੇ ਪਹੁੰਚਾ ਤਾਂ ਕਿ ਮੇਰਾ ਸਮੇਂ ਬਰਬਾਦ ਨਾ ਹੋਵੇ ਕਿਉਂਕਿ ਇਸ ਕਾਰਨ ਮੇਰਾ ਅਤੇ ਤੁਹਾਡਾ ਸਮਾਂ ਸਮਾਂ ਦੋਵਾਂ ਦਾ ਬਰਬਾਦ ਹੋਵੇਗਾ ਅਤੇ ਮੈਨੂੰ ਜਲਦੀ ਤੋਂ ਜਲਦੀ ਇਹ ਦੱਸ ਦਿੱਤਾ ਜਾਵੇ ਕਿ ਮੈਂ ਤੁਹਾਨੂੰ ਕਿੱਥੇ ਮਿਲਾ ਅਤੇ ਕਿੰਨੇ ਵਜੇ ਮਿਲਾ ਧੰਨਵਾਦ